ਪੰਜਾਬ ਰਾਜ ਵਿੱਚ ਪੰਜਾਬ ਨੈਸ਼ਨਲ ਬੈਂਕ ਪੰਜਾਬ ਐਂਡ ਸਿੰਧ ਬੈਂਕ ਅਤੇ ਸਟੇਟ ਬੈਂਕ ਔਫ ਇੰਡੀਆ ਪ੍ਰਮੁੱਖ ਹਨ ਜੋ ਕਿ ਬੀਮਾ ਸੇਵਾਵਾਂ ਦੀ ਪੇਸ਼ਕਸ਼ ਕਰਦੇ ਹਨ ਅਤੇ ਜਿਨ੍ਹਾਂ ਵਿੱਚ ਲੋਕ ਵੱਧ ਤੋਂ ਵੱਧ ਆਪਣਾ ਪੈਸਾ ਜਮ੍ਹਾਂ ਕਰਵਾਉਂਦੇ ਹਨ ਅਜ ਅਤੇ ਜੇਕਰ ਅੰਤਰਰਾਸ਼ਟਰੀ ਬੈਂਕਾਂ ਦੀ ਗੱਲ ਕੀਤੀ ਜਾਵੇ ਤਾਂ ਆਈ ਸੀ ਆਈ ਸੀ ਆਈ ਬੈਂਕ ਐੱਚ ਡੀ ਐੱਫ ਸੀ ਬੈਂਕ ਜੋ ਕਿ ਪ੍ਰਾਈਵੇਟ ਹਨ ਉਹ ਅੰਤਰਰਾਸ਼ਟਰੀ ਸੇਵਾਵਾਂ ਵੀ ਕੁਝ ਹੱਦ ਤੱਕ ਪ੍ਰਦਾਨ ਕਰਦੇ ਹਨ ਪਰ ਇਹਨਾਂ ਬੈਂਕਾਂ ਵਿੱਚ ਇੰਟਰਸਟ ਰੇਟ ਬਹੁਤ ਹੀ ਜ਼ਿਆਦਾ ਹੁੰਦਾ ਹੈ ਇਸ ਕਰਕੇ ਲੋਕ ਜ਼ਿਆਦਾਤਰ ਸਟੇਟ ਬੈਂਕ ਔਫ ਇੰਡੀਆ ਜੋ ਕਿ ਸਰਕਾਰੀ ਹੈ ਦੀ ਵਰਤੋਂ ਕਰਦੇ ਹਨ